ਸਤਿ ਸ਼੍ਰੀ ਅਕਾਲ ਜੀ ਤੁਸੀਂ ਸਿਲਾਈ ਜਾਂ ਬੁਣਾਈ ਦੌਰਾਨ ਕਿਹੜੇ ਸਾਧਨ ਦੀ ਵਰਤੋਂ ਕਰਦੇ ਹੋਏ ਤੁਸੀਂ ਇਸ ਚੀਜ਼ ਬਾਰੇ ਪੁੱਛਿਆ ਹੈ ਮੈਂ ਸਿਲਾਈ ਅਤੇ ਬੁਣਾਈ ਕਰਨ ਲਈ ਮੈਂ ਸਿਲਾਈ ਤਕਰੀਬਨ ਸਲਾਈ ਹੀ ਕਰਦੀ ਹਾਂ ਸਿਲਾਈ ਕਰਨ ਲਈ ਮੈਂ ਸਿਲਾਈ ਮਸ਼ੀਨ ਦੀ ਵਰਤੋਂ ਕਰਦੀ ਹਾਂ ਅਤੇ ਨਵੇਂ ਜ਼ਮਾਨੇ ਦੀ ਸਿਲਾਈ ਦੀ ਮਸ਼ੀਨ ਸਲਾਈ ਵਾਲੀ ਮਸ਼ੀਨ ਵਰਤਦੀ ਹਾਂ ਅਤੇ ਉਹਨੂੰ ਬਿਹਤਰ ਬਣਾਉਣ ਲਈ ਅੱਜ ਕੱਲ੍ਹ ਦੇ ਜ਼ਮਾਨੇ ਦੀ ਸਿਲਾਈ ਵਾਲੀ ਮਸ਼ੀਨ ਦਾ ਵਰਤੋਂ ਕਰਦੀ ਹਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਬਹੁਤ ਵਧੀਆ ਢੰਗ ਨਾਲ ਮੈਂ ਇਹ ਕੰਮ ਕਰ ਲੈਦੀ ਹਾਂ ਅਤੇ ਇਹ ਨਵੇਂ ਜ਼ਮਾਨੇ ਦੀ ਸਿਲਾਈ ਮਸ਼ੀਨ ਹੈ ਮੇਰੀ ਕਾਫ਼ੀ ਮਦਦਗਾਰ ਹੈ ਇਹਦੇ ਨਾਲ ਮੈਨੂੰ ਕਾਫ਼ੀ ਮਦਦ ਮਿਲਦੀ ਹੈ ਇਹਦੇ ਨਾਲ ਮੇਰਾ ਕੰਮ ਕਾਫ਼ੀ ਸੌਖਾ ਹੋ ਗਿਆ ਹੈ ਪਹਿਲਾਂ ਅਸੀਂ ਹੱਥ ਵਾਲੀ ਮਸ਼ੀਨ ਦੇ ਨਾਲ ਕਾਫ਼ੀ ਟਾਈਮ ਲੱਗਦਾ ਸੀ ਅੱਜ ਕੱਲ੍ਹ ਕੰਮ ਕਰਨਾ ਬਹੁਤ ਸੌਖਾ ਹੋ ਗਿਆ ਹੈ ਅਤੇ ਮੈਂ ਉਹ ਹੀ ਨਵੇਂ ਜ਼ਮਾਨੇ ਦੀ ਸਿਲਾਈ ਮਸ਼ੀਨ ਦਾ ਵਰਤੋਂ ਕਰਦੀ ਹਾਂ ਉਹਦੇ ਨਾਲ ਮੇਰਾ ਜਲਦੀ ਕੰਮ ਹੋ ਜਾਂਦਾ ਹੈ ਅਤੇ ਮੈਂ ਜਲਦੀ ਫਰੀ ਹੋ ਜਾਂਦੀ ਹਾਂ ਬਹੁਤ ਵਧੀਆ ਲੱਗਦਾ ਅਤੇ ਕੰਮ ਵੀ ਜ਼ਿਆਦਾ ਹੋ ਜਾਂਦਾ ਹੈ ਕਿ ਜਿਹੜਾ ਕੰਮ ਅਸੀਂ ਇੱਕ ਦਿਨ ਵਿੱਚ ਕਰਦੇ ਹਾਂ ਅੱਧੇ ਅੱਧੇ ਦਿਨ ਵਿੱਚ ਸਾਡਾ ਕੰਮ ਜਲਦੀ ਮੁੱਕ ਜਾਂਦਾ ਹੈ ਅਤੇ ਉਹਨੂੰ ਬੇਹਤਰ ਬਣਾਉਣ ਲਈ ਅੱਜ ਦੇ ਜ਼ਮਾਨੇ ਦੀ ਜਿਹੜੀ ਨਵੀਂ ਤਕਨੀਕ ਦੀ ਮਸ਼ੀਨ ਹੈ ਉਹ ਬਹੁਤ ਕਾਰਗਾਰ ਸਿੱਧ ਹੋਈ ਇਸ ਕਰਕੇ ਮੈਂ ਉਹ ਹੀ ਵਰਤੋਂ ਕਰਦੀ ਹਾਂ ਅਤੇ ਉਹ ਵਰਤੋਂ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਆਪਣਾ ਸਾਰਾ ਕੰਮ ਟਾਈਮ ਸਿਰ ਕਰ ਲੈਂਦੀ ਹਾਂ ਅਤੇ ਮੈਨੂੰ ਕੋਈ ਵੀ ਪ੍ਰੋਬਲਮ ਮੁਸ਼ਕਿਲ ਨਹੀਂ ਆਉਂਦੀ ਸਾਰਾ ਕੰਮ ਟਾਈਮ ਨਾਲ ਹੋ ਜਾਂਦਾ ਹੈ ਅਤੇ ਵਧੀਆ ਲੱਗਦਾ ਹੈ